ਮੈਨੂੰ ਘਰ ਵਿੱਚ ਸਫਾਈ ਅਤੇ ਕੁਕਿੰਗ ਕਰਨੀ ਪਸੰਦ ਹੈ ਪਰੰਤੂ ਕੁਕਿੰਗ ਮੈਂ ਜ਼ਿਆਦਾ ਟਾਈਮ ਕਰਦੀ ਹਾਂ ਕਿਉਂਕਿ ਮੈਨੂੰ ਕੁਕਿੰਗ ਜ਼ਿਆਦਾ ਪਸੰਦ ਹੈ ਕੁਕਿੰਗ ਦੇ ਵਿੱਚ ਮੈਂ ਫਾਸਟ ਫੂਡ ਬਣਾ ਲੈਂਦੀ ਹਾਂ ਜਿਵੇਂ ਕਿ ਪਾਸਤਾ ਨੂਡਲ ਮੈਗੀ ਸਪਰਿੰਗ ਰੋਲ ਆਦਿ ਸਬਜ਼ੀਆਂ ਦੇ ਵਿੱਚ ਮੈਂ ਹਰੇਕ ਤਰ੍ਹਾਂ ਦੀ ਸਬਜ਼ੀ ਬਣਾ ਸਕਦੀ ਹਾਂ ਮੈਨੂੰ ਦਾਲ਼ਾਂ ਬਣਾਉਣੀਆਂ ਵੀ ਆਉਂਦੀਆਂ ਹਨ ਮਿੱਠੇ ਦੇ ਵਿੱਚ ਮੈਂ ਖੀਰ ਬਣਾ ਸਕਦੀ ਹਾਂ ਅਤੇ ਮੈਂ ਘਰ ਵਿੱਚ ਬਣੀ ਸ਼ੁੱਧ ਦੇਸੀ ਘੀ ਦੀ ਬਰਫੀ ਬਣਾ ਸਕਦੀ ਹਾਂ ਜੋ ਕਿ ਮੇਰੇ ਘਰਦਿਆਂ ਨੂੰ ਵੀ ਬਹੁਤ ਪਸੰਦ ਹੁੰਦੀ ਹੈ ਆਸ ਪਾਸ ਦੇ ਲੋਕ ਜੋ ਕਿ ਮੈਨੂੰ ਜਾਣਦੇ ਹਨ ਅਤੇ ਮੇਰੇ ਰਿਸ਼ਤੇਦਾਰ ਮੈਂ ਅਕਸਰ ਉਹਨਾਂ ਨੂੰ ਆਪਣੇ ਦੁਆਰਾ ਬਣਾਈ ਗਈ ਡਿਸ਼ਿਜ਼ ਖਿਲਾਉਂਦੀ ਹਾਂ ਜੋ ਕਿ ਮੇਰੀ ਬਹੁਤ ਤਾਰੀਫ ਕਰਦੇ ਹਨ ਕਿ ਤੁਸੀਂ ਇਹ ਬਹੁਤ ਵਧੀਆ ਬਣਾਈ ਹੈ